ਗਾਉਣ ਵਿੱਚ ਸਾਹ ਦੀ ਨਿਰੰਤਰਤਾ ਲਈ ਅਸੀਂ ਇਸ ਵਿੱਚ ਬਹੁਤ ਜ਼ਿਆਦਾ ਬਹੁਤ ਤਰ੍ਹਾਂ ਦੇ ਤਰੀਕੇ ਹਨ ਜਿਸ ਨਾਲ ਅਸੀਂ ਆਪਣੇ ਸਾਹ ਦੀ ਭੂਮਿਕਾ ਨੂੰ ਕਿੱਦਾਂ ਸੁਧਾਰਿਆ ਜਾ ਸਕਦਾ ਹੈ ਜਿਵੇਂ ਕਿ ਅਸੀਂ ਗਾਉਣ ਲੱਗੇ ਅਸੀਂ ਆਪਣੀ ਬੋ ਗਲੇ ਨੂੰ ਨਮਕ ਨਮਕ ਵਾਲੇ ਪਾਣੀ ਨਾਲ ਗਰਾਰੇ ਕੀਤੇ ਜਾ ਸਕਦੇ ਹਨ ਅਸੀਂ ਜਿਮ ਜਾ ਸਕਦੇ ਹਨ ਜਿਸ ਨਾਲ ਸਾਡੀ ਸਟੈਮੀਨਾ ਵਧੇ ਜਿਸ ਨਾਲ ਜਿੱਦਾਂ ਰਨਿੰਗ ਕਰ ਸਕਦੇ ਹਨ ਯੋਗਾ ਕਰ ਸਕਦੇ ਹਨ ਮੈਡੀਟੇਸ਼ਨ ਕਰ ਸਕਦੇ ਹਨ ਜਿਸ ਨਾਲ ਸਾਡੇ ਦਿਮਾਗ ਅਤੇ ਸਾਡੇ ਸਰੀਰ ਦੀ ਸਾਹ ਅਤੇ ਪ੍ਰਕਿਰਿਆ ਬਹੁਤ ਜ਼ਿਆਦਾ ਸੁਧਰ ਜਾਂਦੀ ਹੈ ਜਿਸ ਨਾਲ ਸਾਡੇ ਸਰੀਰ ਨੂੰ ਸਾਹ ਵੀ ਸਾਨੂੰ ਰੋਕਣ ਦੀ ਅਤੇ ਗਾਉਣ ਵਿੱਚ ਬਹੁਤ ਜ਼ਿਆਦਾ ਸਾਡੇ ਗਲਾ ਸਾਫ ਹੁੰਦਾ ਇਸ ਚੀਜ਼ ਵਿੱਚ ਕਈ ਤਰ੍ਹਾਂ ਦੇ ਸਾਨੂੰ ਪ੍ਰੋਡਕਟ ਵੀ ਆਉਂਦੇ ਹਨ ਜਿਸ ਨਾਲ ਸਾਨੂੰ ਗਲੇ ਵਿੱਚ ਯੂਜ ਕਰਨ ਨਾਲ ਸਾਡਾ ਗਲਾ ਸਾਫ਼ ਹੁੰਦਾ ਹੈ ਅਤੇ ਸਾਨੂੰ ਸਾਹ ਵਿੱਚ ਸਾਨੂੰ ਜ਼ਿਆਦਾਤਰ ਗਾਉਣ ਦੀ ਸੁਰੀਲੀ ਆਵਾਜ਼ ਹੋ ਜਾਂਦੀ ਹੈ ਗਲਾ ਸਾਫ਼ ਹੁੰਦਾ ਹੈ ਕਈ ਇਸ ਤਰ੍ਹਾਂ ਦੇ ਕਈ ਬਹੁਤ ਸਾਰੇ ਮਾਰਕੀਟ ਵਿੱਚ ਵਧੀਆ ਵਧੀਆ ਪ੍ਰੋਡਕਟ ਵੀ ਆਉਂਦੇ ਹਨ ਇਸ ਲਈ ਸਾਨੂੰ ਕਵੀ ਕਦੇ ਵੀ ਇਸ ਲਈ ਅਸੀਂ ਇਸ ਚਰਚਾ ਕਰ ਸਕਦੇ ਹਾਂ ਜਿਸ ਨੂੰ ਇਸ ਦੀ ਸਹਾਇਤਾ ਬਹੁਤ ਜ਼ਿਆਦਾ ਜ਼ਰੂਰੀ ਕੀਤੀ ਜਾਂਦੀ ਹੈ